ਹਾਂਜੀ ਇੱਕ ਯਾਦਗਾਰ ਚੜ੍ਹਾਈ ਯਾਤਰਾ ਮੈਂ ਵੈਸ਼ਨੋ ਦੇਵੀ ਦੀ ਕੀਤੀ ਹੈ ਇੱਥੋਂ ਮੈਂ ਪਹਿਲਾਂ ਆਪਣੀ ਸਾਰੀ ਸਹੇਲੀਆਂ ਨਾਲ ਜਦੋਂ ਮੈਂ ਬੀਏ 'ਚ ਪੜ੍ਹਦੀ ਸੀ ਤਾਂ ਅਸੀਂ ਗਏ ਸੀ ਸਾਰੀ ਸਹੇਲੀਆਂ ਬੱਸ ਵਿੱਚ ਗਈਆਂ ਸੀ ਅਤੇ ਓਹ ਅੱਗੇ ਜਾ ਕੇ ਜਦੋਂ ਵੈਸ਼ਨੋ ਦੇਵੀ ਦੀ ਚੜ੍ਹਾਈ ਜਿਹੜੀ ਹੈਗੀ ਆ ਉਹ ਹੈਗੀ ਆ ਕੱਟੜੇ ਤੋਂ ਚੌਦ੍ਹਾਂ ਕਿਲੋਮੀਟਰ ਜੋ ਅਸੀਂ ਪੈਦਲ ਕੀਤੀ ਸੀ ਅਤੇ ਇੱਕ ਵਾਰ ਤਾਂ ਮੈਨੂੰ ਡਰ ਲੱਗ ਰਿਹਾ ਸੀ ਕਿ ਅਸੀਂ ਚੌਦ੍ਹਾਂ ਕਿਲੋਮੀਟਰ ਦੀ ਯਾਤਰਾ ਕਿਵੇਂ ਕਰਾਂਗੇ ਬਟ ਜਦੋਂ ਮੇਰੀ ਸਹੇਲੀਆਂ ਨੇ ਮੈਨੂੰ ਸਾਰਿਆਂ ਨੇ ਮੋਟੀਵੇਟ ਕੀਤਾ ਨਹੀਂ ਨਹੀ ਆਪਾਂ ਪੈਦਲ ਕਰਨੀ ਆ ਸਾਰੀ ਯਾਤਰਾ ਤਾਂ ਅਸੀਂ ਸਾਰੇ ਹੀ ਸਹੇਲੀਆਂ ਨੇ ਇਕੱਠੇ ਮਿਲ ਕੇ ਉਹ ਯਾਤਰਾ ਪੈਦਲ ਕੀਤੀ ਜਿਉਂ ਜਿਉਂ ਜਾਈ ਗਏ ਜਾਈ ਗਏ ਅਸੀ ਤਾਂ ਅੱਗੇ ਸਾਰੇ ਲੋਕਾਂ ਨੂੰ ਦੇਖ ਦੇਖ ਕੇ ਸਾਰੇ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਗਏ ਪਹੁੰਚਦੇ ਗਏ ਜਦੋਂ ਅਸੀਂ ਚੌਦ੍ਹਾਂ ਕਿਲੋਮੀਟਰ ਪਹੁੰਚ ਗਏ ਅੰਦਰ ਜਾ ਕੇ ਗੁਫਾ 'ਚ ਮਾਤਾ ਦੇ ਦਰਸ਼ਨ ਕੀਤੇ ਤਾਂ ਸਾਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਸੰਤੁਸ਼ਟੀ ਮਿਲੀ ਕਿ ਅਸੀਂ ਚੌਦ੍ਹਾਂ ਕਿਲੋਮੀਟਰ ਦੀ ਯਾਤਰਾ ਕਰਕੇ ਆ ਕੇ ਮਾਤਾ ਦੇ ਦਰਸ਼ਨ ਕੀਤੇ ਅਤੇ ਉਸ ਤੋਂ ਬਾਅਦ ਅਸੀਂ ਲੰਗਰ ਵੀ ਕੀਤਾ ਤਾਂ ਵਾਪਸ ਵੀ ਅਸੀਂ ਚੜ੍ਹਾਈ ਉਤਰ ਕੇ ਹੀ ਵਾਪਸ ਆਏ ਠੀਕ ਹੈ ਅਤੇ ਸਾਨੂੰ ਐਂ ਲੱਗਿਆ ਕਿ ਵੀ ਸਾਨੂੰ ਉੱਥੇ ਜਾ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਅਸੀਂ ਪਹਿਲਾਂ ਮੈਨੂੰ ਕਿਉਂਕਿ ਮੈਨੂੰ ਹਾਲਾਂਕਿ ਹਾਈਟ ਤੋਂ ਬਹੁਤ ਡਰ ਲੱਗਦਾ ਹੈ ਪਰ ਜਦੋਂ ਮੈਂ ਚੜ੍ਹਾਈ ਚੜ੍ਹਦੀ ਗਈ ਤਾਂ ਮੇਰਾ ਉਹ ਸਾਰਾ ਜਿਹੜਾ ਡਰ ਹੈ ਕਿ ਦੂਰ ਹੁੰਦਾ ਗਿਆ ਕਿਉਂਕਿ ਜਦੋਂ ਅਸੀਂ ਚੜ੍ਹਾਈ ਚੜ੍ਹਦੇ ਜਾਂਦੇ ਹਾਂ ਸਾਨੂੰ ਇੱਕ ਵਾਰੀ ਤਾਂ ਸਾਹ ਵੀ ਚੜ੍ਹਦਾ ਹੈ ਬਟ ਹੌਲੀ ਹੌਲੀ ਉਹ ਸਾਡਾ ਸਾਰਾ ਡਰ ਅਤੇ ਸਾਹ ਠੀਕ ਹੁੰਦਾ ਗਿਆ ਕਿਉਂਕਿ ਚੜ੍ਹਾਈ ਚੜ੍ਹ ਕੇ ਸਾਨੂੰ ਇਵੇਂ ਸੀ ਕਿ ਅਸੀਂ ਮਾਤਾ ਦੇ ਦਰਸ਼ਨ ਕਰਨੇ ਨੇ ਦਰਸ਼ਨ ਕਰਕੇ ਸਾਨੂੰ ਬਹੁਤ ਸਕੂਨ ਮਿਲਿਆ ਅਤੇ ਜਿਹੜਾ ਸੀ ਜਿਹੜਾ ਮੇਰਾ ਪਹਾੜੀ 'ਤੇ ਚੜ੍ਹਨ ਦਾ ਐਕਸਪੀਰੀਅੰਸ ਸੀ ਉਹ ਵੀ ਬਹੁਤ ਅੱਛਾ ਰਿਹਾ ਅਤੇ ਉਸ ਤੋਂ ਬਾਅਦ ਅਸੀਂ ਉਸ ਤੋਂ ਬਾਅਦ ਵੀ ਹੁਣ ਦੋ ਤਿੰਨ ਵਾਰੀ ਜਾ ਆਏ ਤਾਂ ਮੇਰਾ ਉਹ ਸਾਰਾ ਸੀ ਜਿਹੜਾ ਡਰ ਦੂਰ ਹੋ ਗਿਆ ਉੱਥੇ ਜਾ ਕੇ ਜਿਵੇਂ ਆਪਾਂ ਕਹਿੰਦੇ ਸਿੱਖਣ ਨੂੰ ਕੀ ਮਿਲਿਆ ਸਾਨੂੰ ਉੱਥੋਂ ਦਾ ਕਲਚਰ ਦੇਖਣ ਨੂੰ ਮਿਲਿਆ ਕਿਵੇਂ ਲੋਕ ਉੱਥੇ ਮਾਤਾ ਦੇ ਦਰਸ਼ਨ ਕਰਨ ਲਈ ਕਿਵੇਂ ਕਿਵੇਂ ਆਉਂਦੇ ਨੇ ਕੋਈ ਬੱਸ 'ਚ ਆਉਂਦਾ ਕੋਈ ਟ੍ਰੇਨ 'ਚ ਆਉਂਦਾ ਕੋਈ ਬਾਏ ਏਅਰ ਆਉਂਦਾ ਬਟ ਜਿਹੜੀ ਅਸੀਂ ਸੀ ਯਾਤਰਾ ਉਹ ਬਹੁਤ ਜ਼ਿਆਦਾ ਪੈਦਲ ਤੁਰ ਕੇ ਕੀਤੀ ਸੀ ਤਾਂ ਸਾਨੂੰ ਮੈਨੂੰ ਇਹ ਜੇ ਸਾਰੀਆਂ ਚੀਜ਼ਾਂ ਦਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਉਸ ਤੋਂ ਬਾਅਦ ਮੈਂ ਹੁਣ ਦੋ ਤਿੰਨ ਵਾਰ ਆਪਣੀ ਫੈਮਲੀ ਨਾਲ ਆਪਣੇ ਪੇਰੈਂਟਸ ਨਾਲ ਵੀ ਵੈਸ਼ਨੋ ਦੇਵੀ ਦੋ ਤਿੰਨ ਵਾਰੀ ਜਾ ਆਈ ਜਿਹੜਾ ਮੇਰਾ ਹਾਈਟ ਦਾ ਡਰ ਸੀ ਸਾਰਾ ਕੁਛ ਦੂਰ ਹੋ ਗਿਆ